ਕੀ ਤੁਸੀਂ ਤੁਹਾਡੇ ਬੱਚਿਆਂ ਨੂੰ ਬੈਂਕਿੰਗ ਖੇਤਰ ਦੇ ਵਿੱਚ ਕਰੀਅਰ ਨੂੰ ਤਰਜੀਹ ਦੇਵੋਗੇ ਤੁਹਾਡੇ ਆਦਰਸ਼ ਭੂਮਿਕਾ ਕੀ ਹੋਵੇਗੀ ਅਤੇ ਕਿਉਂ ਮੇਰੀ ਆਦਰਸ਼ ਭੂਮਿਕਾ ਹੋਵੇਗੀ ਕਿ ਮੈਂ ਉਹਨਾਂ ਨੂੰ ਜ਼ਰੂਰ ਹੀ ਇਸ ਲਾਈਨ ਵਿੱਚ ਭੇਜਣਾ ਚਾਹੂੰਗਾ ਕਿਉਂਕਿ ਬੈਂਕਿੰਗ ਖੇਤਰ ਦੇ ਬਹੁਤ ਵਧੀਆ ਖੇਤਰ ਹੈ ਅਤੇ ਬਹੁਤ ਹੀ ਸੋਹਣਾ ਖੇਤਰ ਹੈ ਬੈਂਕਿੰਗ ਖੇਤਰ ਦੇ ਵਿੱਚ ਜਾਣ ਲਈ ਪਹਿਲਾਂ ਮੈਂ ਆਪਣੇ ਬੱਚਿਆਂ ਨੂੰ ਟੈਂਨਥ ਤੱਕ ਮੈਥਸ ਬਹੁਤ ਵਧੀਆ ਕਰਵਾਉਂਗਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਮਰਸ ਲੈਣ ਦੀ ਸਲਾਹ ਦਊਂਗਾ ਅਤੇ ਉਹਨਾਂ ਦੀ ਟਿਊਸ਼ਨ ਰਖਵਾਉਂਗਾ ਕਾਮਰਸ ਵਿੱਚ ਕਰਦੇ ਕਰਦੇ ਟਿਊਸ਼ਨ ਕਰਦੇ ਕਰਦੇ ਜਦੋਂ ਉਹ ਆਪਣੇ ਬਹੁਤ ਵਧੀਆ ਨੰਬਰਾਂ ਨਾਲ ਆਪਣੀ ਟਵੈਲਥ ਕੰਪਲੀਟ ਕਰ ਲੂਗੇ ਉਸ ਤੋਂ ਬਾਅਦ ਮੈਂ ਇੱਕ ਬਹੁਤ ਹੀ ਵਧੀਆ ਕੋਲਜ ਜਾ ਕੇ ਉਹਨਾਂ ਦੀ ਐਡਮਿਸ਼ਨ ਕਰਵਾਊਂਗਾ ਬੀ ਕੌਮ ਵਿੱਚ ਬੀ ਕੌਮ ਵਿੱਚ ਉਹਨਾਂ ਨੂੰ ਮੈਂ ਅਖਵਾਂਟ ਅਕਾਊਂਟਸ ਰਖਵਾਊਂਗਾ ਮੈਂ ਅਤੇ ਇਹ ਇੱਕ ਦੋ ਸਬਜੈਕਟ ਹੋਰ ਬੈਂਕਿੰਗ ਦੇ ਰਿਲੇਟਿਡ ਰਖਵਾਉਂਗਾ ਅਤੇ ਉਹਨਾਂ ਦੀ ਟਿਊਸ਼ਨ ਵੀ ਰਖਵਾਉਂਗਾ ਅਤੇ ਜਦੋਂ ਉਹਨਾਂ ਦੀ ਡਿਗਰੀ ਕੰਪਲੀਟ ਹੋ ਜਾਵੇਗੀ ਅਤੇ ਫਿਰ ਮੈਂ ਉਹਨਾਂ ਨੂੰ ਕਿਸੇ ਇੱਕ ਪਾਰਟ ਟਾਈਮ ਜੋਬ 'ਤੇ ਲਗਵਾ ਦੂਗਾ ਜੋ ਬੈਂਕਿੰਗ ਵਿੱਚ ਉਹਨਾਂ ਦੀ ਮਦਦ ਕਰੇ ਉਸ ਤੋਂ ਬਾਅਦ ਮੈਂ ਉਹਨਾ ਦੀ ਹੋਰ ਮਦਦ ਕਰਨ ਦੇ ਲਈ ਉਹਨਾਂ ਦੇ ਫੋਰਮ ਵੀ ਭਰਵਾਉਂਦਾ ਰਹੂੰਗਾ ਇਸ ਸਾਰਾ ਟਾਈਮ ਵਿੱਚੋਂ ਮੈਂ ਉਹਨਾਂ ਨੂੰ ਫੋਰਮ ਭਰਵਾਉਂਗਾ ਅਲੱਗ ਅਲੱਗ ਨੌਕਰੀਆਂ ਲਈ ਬੈਂਕ ਲਈ ਨਿਕਲਦੀਆਂ ਹਨ ਕਿਉਂਕਿ ਹਰ ਇੱਕ ਨੌਕਰੀ ਬੈਂਕ ਵਿੱਚ ਬਹੁਤ ਹੀ ਮਦਦ ਕਰੇਗੀ ਉਹਨਾਂ ਨੂੰ ਅਤੇ ਉਹਨਾਂ ਵੀ ਅਗਰ ਮੈਂ ਚਾਹਾਂ ਤਾਂ ਉਹਨਾਂ ਦੀ ਮੈਂ ਪੀ ਐੱਨ ਬੀ ਮਤਲਬ ਪੰਜਾਬ ਨੈਸ਼ਨਲ ਬੈਂਕ ਵਿੱਚ ਕਰਵਾਉਂਗਾ ਕਿਉਂਕਿ ਸਰਕਾਰੀ ਬੈਂਕ ਹੈ ਅਤੇ ਬਹੁਤ ਹੀ ਵਧੀਆ ਬੈਂਕ ਹੈ ਉਸ ਵਿੱਚ ਅਗਰ ਉਹਨਾਂ ਨੂੰ ਕੋਈ ਵੀ ਪੋਸਟ ਮਿਲਦੀ ਹੈ ਅਤੇ ਉਹ ਬਹੁਤ ਹੀ ਵਧੀਆ ਹੋਏਗਾ ਜਿਵੇਂ ਕਿ ਅਗਰ ਮੰਨ ਲਉ ਉਹਨਾਂ ਨੂੰ ਪੋਸਟ ਮਿਲਦੀ ਹੈ ਬ ਉਹਦੀ ਬੈਂਕ ਮੈਨੇਜਰ ਦੀ ਪੋਸਟ ਮਿਲਦੀ ਹੈ ਉਹ ਬਹੁਤ ਹੀ ਵਧੀਆ ਪੋਸਟ ਹੈ ਕਿਉਂਕਿ ਉਹਦੇ ਵਿੱਚ ਤੁਹਾਨੂੰ ਜਿਹੜੇ ਸਭ ਆਰਾ ਆਰਾਮ ਨਾਲ ਬੋਲੂਗੇ ਤੁਹਾਡੇ ਨਾਲ ਇੱਜ਼ਤ ਨਾਲ ਬੋਲੂਗੇ ਜਿਹੜਾ ਵੀ ਸਟਾਫ ਹੋ ਚਾਹੇ ਉਹ ਕੈਸ਼ੀਅਰ ਹੋਵੇ ਚਾਹੇ ਉਹ ਗਾਰਡ ਹੋਵੇ ਚਾਹੇ ਕੋਈ ਵੀ ਹੋਏ ਚਾਹੇ ਕੋਈ ਕਸਟਮਰ ਹੋਏ ਤੁਹਾਡੇ ਨਾਲ ਬਹੁਤ ਹੀ ਇੱਜ਼ਤ ਨਾ ਬੋਲੂਗੇ ਬਹੁਤ ਹੀ ਵਧੀਆ ਲਹਿਜੇ ਨਾਲ ਬੋਲੂਗੇ ਅਤੇ ਸਭ ਤੁਹਾਡੀ ਰਿਸਪੈਕਟ ਕਰੂਗੇ ਸਭ ਤੁਹਾਡੇ ਸਨਮਾਨ ਕਰੂਗੇ ਤਾਂ ਕਰਕੇ ਬੈਂਕਿੰਗ ਦਾ ਡਿਪਾਰਟਮੈਂਟ ਬਹੁਤ ਹੀ ਵਧੀਆ ਹੈ ਅਤੇ ਮੈਂ ਆਪਣੇ ਬੱਚਿਆਂ ਨੂੰ ਇਸ ਖੇਤਰ ਵਿੱਚ ਜ਼ਰੂਰ ਭੇਜਣਾ ਚਾਹਾਂਗਾ